ਪੰਜਾਬੀ ਗਾਇਕੀ ਵਿੱਚ ਔਰਤਾਂ ਦਾ ਬਹੁਤ ਮਸ਼ਹੂਰ ਬਹੁਤ ਜ਼ਿਆਦਾ ਭੂਮਿਕਾ ਹੈ ਕਿਉਂਕੀ ਜਿੱਥੋਂ ਤੱਕ ਦੇਖਿਆ ਜਾਂਦਾ ਹੈ ਕਿ ਪੰਜਾਬ ਦੀਆਂ ਔਰਤਾਂ ਹਰ ਕਿੱਤੇ ਦੇ ਵਿੱਚ ਹਰ ਕੰਮ ਦੇ ਵਿੱਚ ਅੱਗੇ ਆ ਰਹੀਆਂ ਹਨ ਹਰ ਭੂਮਿਕਾ ਨੂੰ ਪੰਜਾਬੀ ਔਰਤਾਂ ਬਹੁਤ ਚੰਗੇ ਢੰਗ ਦੇ ਨਾਲ ਨਿਭਾ ਰਹੀਆਂ ਹਨ ਪੰਜਾਬ ਦੀ ਗਾਇਕੀ ਦੇ ਵਿੱਚ ਬਹੁਤ ਔਰਤਾਂ ਮਸ਼ਹੂਰ ਹੋਈਆਂ ਨੇ ਜਿਹਨਾਂ ਦੇ ਨਾਮ ਆਪਾਂ ਸਾਰਿਆਂ ਦੇ ਨਹੀਂ ਲੈ ਸਕਦੇ ਸੋ ਇਸ ਕਰਕੇ ਹਰ ਕਿੱਤੇ ਦੇ ਵਿੱਚ ਔਰਤ ਮਸ਼ਹੂਰ ਹੈ ਭੂਮਿਕਾ ਆਪਣੀਆਂ ਪੂਰੀਆਂ ਨਿਭਾ ਰਹੀਆਂ ਨੇ ਇਸੇ ਤਰ੍ਹਾਂ ਹੀ ਗਾਇਕੀ ਖੇਤਰ ਦੇ ਵਿੱਚ ਵੀ ਔਰਤਾਂ ਆਪਣੀਆਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਅੱਜ ਕੱਲ੍ਹ ਦੀ ਗਾਇਕੀ ਦੇ ਵਿੱਚ ਜੇ ਔਰਤਾਂ ਦੀ ਗੱਲ ਕਰੀਏ ਤਾਂ ਬਹੁਤ ਆਪਣੀ ਗਾਇਕੀ ਦੇ ਵਿੱਚ ਔਰਤਾਂ ਮਸ਼ਹੂਰ ਹਨ ਜਿਵੇਂ ਕਿ ਸੁਦੇਸ਼ ਕੁਮਾਰੀ ਗੁਰਲੇਜ਼ ਅਖਤਰ ਅਫਸਾਨਾ ਖਾਨ ਰੁਪਿੰਦਰ ਹੋਂਡਾ ਬਹੁਤ ਜ਼ਿਆਦੇ ਨਾਮ ਨੇ ਗਿਣਤੀ ਦੇ ਵਿੱਚ ਨਹੀਂ ਆ ਸਕਦੇ ਅਤੇ ਇਹ ਪੰਜਾਬ ਦੇ ਵਿੱਚ ਸਤਵਿੰਦਰ ਬਿੱਟੀ ਜਸਵਿੰਦਰ ਬਰਾੜ ਅਤੇ ਹੋਰ ਵੀ ਅਨੀਤਾ ਸਮਾਣਾ ਬਹੁਤ ਜ਼ਿਆਦਾ ਔਰਤਾਂ ਨੇ ਜੋ ਗਾਇਕੀ ਦੇ ਵਿੱਚ ਅੱਜ ਬਹੁਤ ਮਸ਼ਹੂਰ ਹਨ ਜਿਵੇਂ ਸੁਦੇਸ਼ ਕੁਮਾਰੀ ਦੇ ਬਹੁਤ ਸੌਂਗ ਮਸ਼ਹੂਰ ਹਨ ਸੋ ਮੇਰੀ ਪਸੰਦੀਦਾ ਗਾਇਕਾ ਸੁਦੇਸ਼ ਕੁਮਾਰੀ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਮਸ਼ਹੂਰ ਹਨ ਸੋ ਉਹਨਾਂ ਦੇ ਗੀਤ ਵੀ ਬਹੁਤ ਪਿਆਰੇ ਹਨ ਸੋ ਉਹ ਆਪਣੀਆਂ ਸਦਰਾਂ ਦੇ ਵਿੱਚ ਆਪਣੇ ਆਵਾਜ਼ ਦੇ ਨਾਲ ਲੋਕਾਂ ਨੂੰ ਮਨ ਮੋਹ ਲੈਂਦੇ ਹਨ ਉਹਨਾਂ ਦੀ ਗਾਇਕੀ ਬਹੁਤ ਹੀ ਚੰਗੀ ਹੈ ਅਤੇ ਉਹਨਾਂ ਦੀ ਆਵਾਜ਼ ਵੀ ਬਹੁਤ ਚੰਗੀ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਬੋਲਣ ਦੀ ਲੋੜ ਨਹੀਂ ਕਿਉਂਕਿ ਸੁਦੇਸ਼ ਕੁਮਾਰੀ ਦੀ ਇੱਕ ਆਪਣੀ ਪਹਿਚਾਣ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਹੈ